ਭਾਰਤ ਵਿਚ ਪਿਛਲੇ ਕੁਝ ਸਮਿਆਂ ਤੋਂ ਨੌਕਰੀਆਂ ਵਿੱਚ ਕਾਫ਼ੀ ਬਦਲਾਵ ਆ ਗਿਆ ਹੈ ਕਿਉਂਕਿ ਹੁਣ ਆਈ ਟੀ ਦਾ ਜ਼ਮਾਨਾ ਆ ਗਿਆ ਹੈ ਅੱਜ ਕੱਲ੍ਹ ਨੌਜਵਾਨ ਆਪਣਾ ਯੂਟੀਊਬ ਦਾ ਚੈਨਲ ਬਣਾ ਲੈਂਦੇ ਹਨ ਅਤੇ ਵੀਡਿਓ ਅਪਲੋਡ ਕਰਦੇ ਹਨ ਇਸ ਨਾਲ ਉਹਨਾਂ ਨੂੰ ਇੱਕ ਰੁਜ਼ਗਾਰ ਮਿਲ ਜਾਂਦਾ ਹੈ ਕੁਝ ਸਿੰਗਰ ਬਣ ਜਾਂਦੇ ਹਨ ਕੁਝ ਕਮੇਡੀਅਨ ਬਣ ਜਾਂਦੇ ਹਨ ਜਾਂ ਫਿਰ ਕੁਝ ਗਾਈਡ ਬਣ ਜਾਂਦੇ ਹਨ ਯਾਤਰੀਆਂ ਨੂੰ ਯਾਤਰਾ ਬਾਰੇ ਦੱਸਣ ਲਈ ਤਾਂ ਇਸ ਤਰ੍ਹਾਂ ਰੁਜ਼ਗਾਰ ਦੇ ਸਾਧਨ ਵਿੱਚ ਕਾਫ਼ੀ ਬਦਲਾਵ ਆ ਗਿਆ ਹੈ ਪਰ ਜਿਹੜਾ ਅੱਜ ਕੱਲ੍ਹ ਦਾ ਨੌਜਵਾਨ ਉਹ ਪੜ੍ਹਿਆ ਲਿਖਿਆ ਨੌਜਵਾਨ ਹੈ ਉਸ ਨੂੰ ਆਪਣੇ ਭਾਰਤ ਵਿੱਚ ਤਾਂ ਜੋ ਵੀ ਸਟੱਡੀ ਕਰੀ ਹੈ ਉਸ ਦੇ ਮੁਤਾਬਿਕ ਨੌਕਰੀ ਨਹੀਂ ਮਿਲ ਰਹੀ ਕਾਫ਼ੀ ਮੁਸ਼ਕਿਲ ਆ ਰਹੀ ਹੈ ਉਸਨੂੰ ਕਿਉਂਕਿ ਮਾਂ ਬਾਪ ਤਾਂ ਬੱਚੇ ਨੂੰ ਕਾਫ਼ੀ ਪੈਸਾ ਲਾ ਕੇ ਪੜ੍ਹਾਉਂਦੇ ਹੈ ਕਾਫ਼ੀ ਹਾਈ ਸਟੱਡੀ ਕਰ ਲੈਂਦੇ ਹੈ ਪਰ ਉਸਨੂੰ ਆਪਣੀ ਸਟਅ ਜੋ ਵੀ ਉਹਨੇ ਪੜ੍ਹਾਈ ਕਰੀ ਆ ਉਹਦੇ ਮ ਮੁਤਾਬਿਕ ਨੌਕਰੀ ਨਹੀਂ ਮਿਲੀ ਉਸ ਨੂੰ ਕਾਫੀ ਦਿੱਕਤ ਹੈ ਰਹੀ ਉਸ ਵਿੱਚ ਇਹ ਵੀ ਇੱਕ ਭਾਰਤ ਵਿਚ ਬਹੁਤ ਬੜੀ ਸਮੱਸਿਆ ਹੈ